ਹੈਲੋ ਤੁਸੀਂ ਖੇਡਾਂ ਦੇ ਟੀਚਰ ਬੋਲ ਰਹੇ ਹੋ ਜੀ ਮੈਂ ਖੇਡਾਂ 'ਚ ਲੱਗਣਾ ਸੀ ਮੈਡਮ ਜੀ ਖੇਡਾਂ ਵਧੀਆ ਹੁੰਦੀਆਂ ਨੇ ਅੱਛਾ ਕਿੰਨੀ ਫੀਸ ਹੁੰਦੀ ਆ ਬੱਚੇ ਕਿੰਨੇ ਨੇ ਉੱਥੇ ਅੱਛਾ ਬੱਚੇ ਕਿੰਨੇ ਹੁੰਦੇ ਨੇ ਖੇਡਾਂ 'ਚ ਅੱਛਾ ਕਿੱਥੇ ਕਿੱਥੇ ਲਗਾਉਂਦੇ ਹੋ ਅੱਛਾ ਜੀ ਹਾਂਜੀ ਮੈਂ ਕਬੱਡ ਕਬੱਡੀ ਅਤੇ ਖੋ ਖੋ ਠੀਕ ਹੈ ਜੀ ਹਾਂਜੀ ਹਾਂਜੀ ਖੇਡਾਂ ਕਦੋਂ ਸ਼ੁਰੂ ਹੋਣਗੀਆਂ ਅੱਛਾ ਜੀ ਅਤੇ ਮੈਡਮ ਦਾ ਸੁਭਾਅ ਕਿਵੇਂ ਹੁੰਦਾ ਗਾ ਮੈਡਮ ਦਾ ਸੁਭਾਅ ਅੱਛਾ ਜੀ

ਕੋਈ ਨਾ ਮੈਡਮ ਜੀ ਮੈਂ ਠੀਕ ਹੈ ਜੀ ਅੱਛਾ ਜੀ ਕੋਈ ਨਾ ਜੀ ਧੰਨਵਾਦ